ਹੈਲੋ ਹਾਂਜੀ ਠੀਕ ਆ ਮੈਂ ਵਧੀਆ ਤੁਸੀਂ ਦੱਸੋ ਕਿੱਦਾਂ ਹੋ ਮੈਂ ਵੀ ਬਹੁਤ ਵਧੀਆ ਹਾਂ ਹੋਰ ਘਰ ਪਰਿਵਾਰ ਕਿੱਦਾਂ ਮੈਂ ਵੀ ਠੀਕ ਹਾਂ ਬਹੁਤ ਵਧੀਆ ਹਾਂ ਹਾਂਜੀ ਬੋਲੋ ਕੁਛ ਨਹੀਂ ਫਰੀ ਹਾਂ ਮੈਂ ਹਾਂਜੀ ਹਾਂਜੀ ਬੋਲੋ ਹਾਂਜੀ ਓਕੇ ਤੁਸੀਂ ਤੁਸੀਂ ਕਰਨਾ ਕੀ ਚਾਹੁੰਦੇ ਹੋ ਕਾਲਜ ਕਿਹੜੀ ਸਟਡੀ ਕਰਨਾ ਚਾਹੁੰਦੇ ਹੋ ਕਿਸ ਓਕੇ ਪੋਸਟ ਗ੍ਰੈਜੂਏਸ਼ਨ ਕਿਹੜੇ ਸਬਜੈਕਟ 'ਚ ਕਰਨੀ ਆ ਓਕੇ ਠੀਕ ਆ ਫਿਰ ਤੁਸੀਂ ਇੱਦਾਂ ਕਰੋ ਕੋਲਜ ਸਾਡੇ ਹੁਸ਼ਿਆਰਪੁਰ ਦੇ ਵਿੱਚ ਕਾਫੀ ਨੇੇੇੇੇ ਪੋਸਟ ਗ੍ਰੈਜੂਏਸ਼ਨ ਦੇ ਲਈ ਜਿੱਦਾਂ ਕਿ ਗੌਰਮੈਂਟ ਕੋਲਜ ਹੁਸ਼ਿਆਰਪੁਰ ਹੈਗਾ ਐਸ ਜੀ ਕੋਲਿਜ ਹੈਗਾ ਡੀ ਏ ਵੀ ਕੋਲਿਜ ਅਤੇ ਤੁਸੀਂ ਉਰੇ ਆ ਕੇ ਤੁਸੀਂ ਗੌਰਮੈਂਟ ਕਾਲਜ ਜਿੱਦਾਂ ਐਡਮਿਸ਼ਨ ਲੈਂਦੇ ਹੋ ਤਾਂ ਬੱਸ ਸਟੈਂਡ ਦੇ ਨੇੜੇ ਆ ਤੁਸੀਂ ਪੈਦਲ ਵੀ ਜਾ ਸਕਦੇ ਹੋ ਉੱਥੇ ਦੇਖ ਲੈਣਾ ਟਰਾਈ ਕਰ ਲੈਣਾ ਔਰ ਜੋ ਕਿ ਗੌਰਮੈਂਟ ਕਾਲਜ ਪਹਿਲਾਂ ਤੋਂ ਪੁਰਾਣੇ ਸਮੇਂ ਤੋਂ ਯੂਨੀਵਰਸਿਟੀ ਵੀ ਰਿਹਾ ਆ ਉਹਨਾਂ ਦਾ ਨਾਮ ਵੀ ਆ ਕਾਫੀ ਅਤੇ ਕਾਫੀ ਵੱਡੇ ਵੱਡੇ ਜਿਹੜੇ ਲੋਕ ਨੇ ਪੜ੍ਹ ਕੇ ਗਏ ਨੇ ਜਿੱਦਾਂ ਡਾਕਟਰ ਮਨਮੋਹਨ ਸਿੰਘ ਹੋ ਗਏ ਡਾਕਟਰ ਸਤਿੰਦਰ ਸਰਤਾਜ ਜੀ ਇੱਥੋਂ ਪੜ੍ਹ ਕੇ ਗਏ ਨੇ ਹੈ ਨਾ ਕਾਲਜ ਦਾ ਕਾਫੀ ਵਧੀਆ ਨਾਮ ਹੈਗਾ ਔਰ ਤੁਹਾਨੂੰ ਇਜ਼ਲੀ ਐਡਮਿਸ਼ਨ ਵੀ ਮਿਲ ਜਾਣੀ ਆ ਇੱਥੇ ਕਾਲਜ ਦੇ ਵਿੱਚ ਤਾਂ ਵਧੀਆ ਇੱਥੇ ਜਿਹੜੇ ਟੀਚਰ ਵੀ ਬਹੁਤ ਵਧੀਆ ਨੇ ਕਾਲਜ ਦੇ ਵਿੱਚ ਜਿਦਾਂ ਮੈਥੇਮੈਟਿਕਸ ਹਾਂ ਟੀਚਰ ਵੀ ਅੱਛਾ ਆ ਦੈਨ ਨਹੀਂ ਬਹੁਤ ਵਧੀਆ ਨੇ ਟੀਚਰ ਇੱਥੋਂ ਮੈਥੇਮੈਟਿਕਸ ਦੇ ਤੁਹਾਨੂੰ ਵਧੀਆ ਮੈਥ ਦੇ ਜਿੱਦਾਂ ਕਿ ਕਰਾਉਣਗੇ ਔਰ ਤੁਹਾਨੂੰ ਇਜੀਲੀ ਸਮਝ ਵੀ ਨਹੀਂ ਇਹ ਤਾਂ ਲੈਕਚਰ ਬੱਚਿਆਂ ਦੇ ਨਹੀਂ ਨਹੀਂ ਇੱਦਾਂ ਨਹੀਂ ਹੈਗਾ ਗਾ ਕਿ ਜਿੱਦਾਂ ਤੁਹਾਨੂੰ ਇਹ ਤਾਂ ਬੱਚਿਆਂ ਦੇ ਉੱਤੇ ਹੁੰਦਾ ਬੱਚੇ ਆਪਣਾ ਲੈਕਚਰ ਲਗਾਉਣ ਨਾ ਲਗਾਉਣ ਪਰ ਟੀਚਰ ਤਾਂ ਹਮੇਸ਼ਾ ਕਲਾਸ ਦੇ ਵਿੱਚ ਆਉਂਦਾ ਹੀ ਇੱਕ ਵਾਰ ਪੁੱਛਦਾ ਆ ਜਿਹੜੇ ਬੱਚੇ ਨਹੀਂ ਲਗਾਉਂਦੇ ਜੇ ਮਿਸ ਕਰਦੇ ਆ ਉਹਨਾਂ ਦੀ ਬੇਵਕੂਫੀਆਂ ਨਹੀਂ ਤਾਂ ਤੁਸੀਂ ਜਿਹੜੇ ਬੱਚੇ ਪੜ੍ਹਨ ਵਾਲੇ ਆ ਉਹ ਪੜ੍ਹ ਸਕਦੇ ਆ ਇੱਦਾਂ ਦੀ ਕੋਈ ਗੱਲ ਨਹੀਂ ਗੀ ਤੁਸੀਂ ਪੜ੍ਹਨਾ ਚਾਹੁੰਦੇ ਆ ਅਗਾਂਹ ਹਾਂਜੀ ਅਤੇ ਇਹ ਕਾਲਜ ਢਾਈ ਵਜੇ ਨੌਂ ਤੋਂ ਨੌਂ ਤੋਂ ਢਾਈ ਵਜੇ ਦਾ ਟਾਈਮ ਹੁੰਦਾ ਆ ਅਤੇ ਨੌਂ ਤੋਂ ਢਾਈ ਦੇ ਵਿੱਚ ਵਿੱਚ ਜਿੰਨੇ ਵੀ ਲੈਕਚਰ ਤੁਹਾਡੇ ਲੱਗਦੇ ਆ ਵਧੀਆ ਆ ਕਾਲਜ ਕੈਂਪਸ ਵੀ ਅੱਛਾ ਆ ਬਿਲਡਿੰਗਜ ਵੀ ਬਹਿਣ ਉੱਠਣ ਦਾ ਫਰਨੀਚਰ ਵਗੈਰਾ ਵੀ ਅੱਛੇ ਨੇ ਔਰ ਮੈਡਮ ਪ੍ਰਿੰਸੀਪਲ ਬਹੁਤ ਅੱਛੇ ਨੇ ਉਹਨਾਂ ਦਾ ਬਿਹੇਵੀਅਰ ਅਤੇ ਹਾਂ ਤੁਸੀਂ ਜਦੋਂ ਐਡਮਿਸ਼ਨ ਕਰਵਾਉਣੀ ਹੋਈ ਦੱਸ ਦੇਣਾ ਕੋਈ ਗੱਲ ਨਹੀਂ ਆਪਾਂ ਐਡਮਿਸ਼ਨ ਕਰਵਾ ਦਵਾਂਗੇ ਤੁਹਾਡੀ ਹੈਲਪ ਵੀ ਕਰ ਦਵਾਂਗੇ ਅਤੇ ਇਹਦੇ ਲਈ ਆ ਜਿੱਦਾਂ ਕਿ ਜੀ ਬੀ ਜੀ ਬਿਲਕੁਲ ਆਪਣੇ ਡਾਕੂਮੈਂਟਸ ਵਗੈਰਾ ਮੈਂ ਵੀ ਜਿਹੜੇ ਐਸ ਸੀ ਸਟੂਡੈਂਟ ਆ ਉਹਨਾਂ ਦੀ ਫੀਸ ਬਹੁਤ ਘੱਟ ਹੁੰਦੀ ਆ ਤਿੰਨ ਕੁ ਹਜ਼ਾਰ ਜਾਂ ਪੈਂਤੀ ਸੌ ਦੇ ਵਿੱਚ ਵਿੱਚ ਐਡਮੀਸ਼ਨ ਫੀਸ ਹੁੰਦੀ ਆ ਔਰ ਨਾਲ ਉਹਨਾਂ ਦਾ ਸਕਾਲਰਸ਼ਿਪ ਵੀ ਬੱਚਿਆਂ ਨੂੰ ਐਸ ਸੀ ਸਟੂਡੈਂਟਸ ਨੂੰ ਮਿਲ ਜਾਂਦੀ ਨੇ ਹੈ ਨਾ ਅਤੇ ਕੋਈ ਇੰਨਾ ਔਖਾ ਨਹੀਂ ਹੈਗਾ ਗਾ ਦੋ ਸਾਲ ਦਾ ਤੁਹਾਡਾ ਪੋਸਟ ਗ੍ਰੈਜੂਏਸ਼ਨ ਦੋ ਸਾਲ ਦੇ ਵਿੱਚ ਤੁਹਾਡੀ ਕੰਪਲੀਟ ਹੋ ਜਾਏਗੀ ਅਤੇ ਹਾਂਜੀ ਓਕੇ ਉਹ ਇੱਦਾਂ ਆ ਕਿ ਹੁਣ ਜਿਹੜਾ ਨਵੀਂ ਪੋਲਸੀ ਆਈ ਆ ਨਾ ਪੰਜਾਬ ਸਰਕਾਰ ਦੀ ਉਹ ਚਾਰ ਸਾਲਾਂ ਦੀ ਬੀ ਏ ਕਰ ਦਿੱਤੀ ਉਹਨਾਂ ਨੇ ਹੈ ਨਾ ਪਰ ਜਿਹੜੇ ਬੱਚਿਆਂ ਨੇ ਕੀ ਕਹਿੰਦੇ ਪੋਸਟ ਗ੍ਰੈਜੂਏਸ਼ਨ ਕਰਨੀ ਆ ਪਿਛਲੇ ਤਿੰਨ ਸਾਲਾਂ ਦੀ ਬੀ ਏ ਕੀਤੀ ਹੋਵੇ ਤਾਂ ਫਿਰ ਉਹਨਾਂ ਲਈ ਦੋ ਸਾਲਾਂ ਦੀ ਆ ਜਿਹੜੇ ਬੱਚਿਆਂ ਨੇ ਚਾਰ ਸਾਲ ਦੀ ਗ੍ਰੈਜੂਏਸ਼ਨ ਕਰਨੀ ਆ ਉਹਨਾਂ ਲਈ ਇੱਕ ਸਾਲ ਦੀ ਹੁੰਦੀ ਆ ਪੋਸਟ ਗ੍ਰੈਜੂਏਸ਼ਨ ਇਸ ਲਈ ਸਾਲ ਕੰਪਲੀਟ ਉੰਨੇ ਹੀ ਲੱਗਦੇ ਆ ਪਰ ਬੀ ਏ ਚਾਰ ਸਾਲਾਂ ਦੀ ਉਹਨਾਂ ਨੇ ਕਰ ਦਿੱਤੀ ਆ ਇਸ ਲਈ ਜੇ ਤੁਸੀਂ ਪਿਛਲੇ ਸਾਲਾਂ 'ਚ ਕੀਤੀ ਹੋਵੇਗੀ ਤਾਂ ਤੁਹਾਨੂੰ ਦੋ ਸਾਲ ਲੱਗਣਗੇ ਅਤੇ ਨਹੀਂ ਤਾਂ ਤੁਸੀਂ ਇੱਕ ਸਾਲ ਹਾਂਜੀ ਦੱਸ ਦੇਣਾ ਜਦੋਂ ਐਡਮਿਸ਼ਨ ਲੈਣੀ ਹਾਂਜੀ ਠੀਕ ਹੈ ਜੀ ਓਕੇ

ਜੀ ਠੀਕ ਆ ਜੀ ਠੀਕ ਜੀ ਓਕੇ ਜੀ ਓਕੇ ਓਕੇ ਥੈਂਕ ਯੂ ਬਾਏ ਥੈਂਕ ਯੂ